ਦੇਖੋ ਜੀ ਮੈਨੂੰ ਜਿਹੜੀ ਚੀਜ਼ ਆਪਣੇ ਘਰ ਦੇ ਵਿੱਚ ਵਧੀਆ ਨਹੀਂ ਲੱਗਦੀ ਉਹ ਹੈਗੀ ਫਰਿੱਜ ਫਰਿੱਜ ਇਸ ਕਰਕੇ ਵਧੀਆ ਨਹੀਂ ਲੱਗਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅੱਧੀਆਂ ਬਿਮਾਰੀਆਂ ਦਾ ਸ਼ਿਕਾਰ ਫਰਿੱਜ ਕਾਰਨ ਹੋ ਰਹੇ ਨੇ ਲੋਕ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਘੜਿਆਂ ਦਾ ਪਾਣੀ ਪੀਂਦੇ ਸੀ ਅਤੇ ਤਾਜ਼ਾ ਪਾਣੀ ਪੀਂਦੇ ਸੀ ਜਿਹਦੇ ਨਾਲ਼ ਲੋਕ ਬਿਮਾਰ ਹੋਣ ਦੇ ਚਾਂਸ ਬਿਲਕੁਲ ਘੱਟ ਹੁੰਦੇ ਸੀ ਪਰੰਤੂ ਅੱਜ ਦੇ ਟਾਈਮ ਦੇ ਵਿੱਚ ਫਰਿੱਜ ਕਾਰਨ ਅੱਧੀਆਂ ਬਿਮਾਰੀਆਂ ਮਨੁੱਖ ਨੂੰ ਥੱਲੇ ਲੈ ਗਈਆਂ ਹਨ ਜਿਸ ਨਾਲ ਉਸ ਦਾ ਰੁਜ਼ਗਾਰ ਵਿੱਚ ਵੀ ਫਰਕ ਪੈਂਦਾ ਹੈ ਅਤੇ ਉਸ ਦੀ ਮਾਨਸਿਕ ਸਿਹਤ ਤਾਂ ਖਰਾਬ ਹੀ ਹੁੰਦੀ ਹੈ ਧੰਨਵਾਦ